ਮੈਂ ਨਾ ਲਾਸਟ ਵੀਕ ਇੱਕ ਐਕਟੀਵਾ ਪ੍ਰੋਡਕਟ ਪਰਚੇਸ ਕੀਤਾ ਐਕਟੀਵਾ ਸਕੂਟਰ ਟੂ ਵੀਲਰ ਉਹ ਨਾ ਯੂਜ ਕਰਕੇ ਤਾਂ ਬੜਾ ਅੱਛਾ ਕੋਈ ਦਿੱਕਤ ਕੋਈ ਨਹੀਂ ਹੈ ਟੈਕਨੀਕਲੀ ਕੋਈ ਪ੍ਰੋਬਲਮ ਨਹੀਂ ਲੇਕਿਨ ਉਹਦਾ ਜਿਹੜਾ ਉੱਪਰ ਦਾ ਜਿੱਥੇ ਸਪੀਡੋਮੀਟਰ ਲੱਗਿਆ ਨਾ ਉਹਦਾ ਜਿਹੜੀ ਉੱਪਰ ਲੱਗੀ ਹੁੰਦੀ ਹੈ ਪੇਪਰ ਟਰਾਂਸਪੇਰੈਂਟ ਪੇਪਰ ਉਹ ਲੱਗਿਆ ਹੋਇਆ ਸੀਗਾ ਅਤੇ ਜਦੋਂ ਮੈਂ ਨਾ ਸਰਿਵਸ ਸੈਂਟਰ ਫਸਟ ਸਰਵਿਸ ਕਰਵਾਉਣ ਗਿਆ ਤਾਂ ਉਹਦੇ 'ਚ ਉਹਨਾਂ ਨੇ ਕੁਛ ਨਹੀਂ ਕੀਤਾ ਠੀਕ ਹੈ ਓਕੇ ਹੈ ਲੇਕਿਨ ਜਦੋਂ ਸੈਕਿੰਡ ਸਰਵਿਸ ਕਰਵਾਉਣ ਗਿਆ ਨਾ ਮੈਂ ਉਹ 'ਤੇ ਜਦ ਦੇਖਿਆ ਵੀ ਪੇਪਰ ਚਿਪਕਿਆ ਹੋਇਆ ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਇਹ ਪੇਪਰ ਜਿਹੜਾ ਹੈਗਾ ਵੀ ਇਹ ਤੁਸੀਂ ਰਿਮੂਵ ਨਹੀਂ ਕੀਤਾ ਫਸਟ ਸਰਵਿਸ ਦੇ ਵਿੱਚ ਤਾਂ ਇਹ ਤੁਹਾਡਾ ਫੋਲਟ ਹੈ ਤਾਂ ਉਹ ਐਕਟੀਵਾ ਜਿਹੜੀ ਏਜੰਸੀ ਹੈਗੀ ਹੈ ਉਹ ਹੋਂਡਾ ਵਾਲੇ ਮੈਨੂੰ ਇਹ ਕਹਿਣ ਵੀ ਨਹੀਂ ਇਹ ਫੋਲਟ ਤੁਹਾਡਾ ਵੀ ਤੁਸੀਂ ਪੇਪਰ ਰਿਮੂਵ ਕਰਨਾ ਸੀ ਅਤੇ ਮੈਂ ਕਿਹਾ ਜੀ ਤੁਸੀਂ ਫਸਟ ਸਰਵਿਸ ਕੀਤੀ ਫਿਰ ਫਸਟ ਸਰਵਿਸ ਕੀ ਕੀਤਾ ਤੁਸੀਂ ਵੀ ਉਹਦੇ 'ਚ ਤੁਸੀਂ ਇਹੀ ਚੀਜ਼ ਚੈੱਕ ਕਰਨੀ ਹੈ ਨਾ ਵੀ ਇਹ ਠੀਕ ਹੈ ਕਿ ਨਹੀਂ ਹੈ ਉਹਦੇ 'ਚ ਕੀ ਪ੍ਰੋਬਲਮ ਹੈਗੀ ਹੈ ਵੀ ਉਹ ਪ੍ਰੋਬਲਮ ਤੁਸੀਂ ਸੋਟ ਆਊਟ ਕਰਨੀ ਸੀਗੀ ਤੁਸੀਂ ਉਹ ਕੀਤੀ ਨਹੀਂ ਹੁਣ ਉਹ ਪੇਪਰ ਚਿਪਕਿਆ ਰਹਿ ਗਿਆ ਤਾਂ ਉਹ ਪੇਪਰ ਤੁਸੀਂ ਰਿਮੂਵ ਕਰਕੇ ਦਿਓ ਅਤੇ ਇਹ ਮੇਰਾ ਜਿਹੜਾ ਐਕਸਪੀਰੀਅੰਸ ਰਿਹਾ ਨਾ ਇਹ ਮਤਲਬ ਬੀਟਰ ਐਕਸਪੀਰੀਅੰਸ ਰਿਹਾ ਉਹਦਾ ਜਦੋਂ ਐਕਟੀਵਾ ਪਰਚੇਸ ਕਰਨ ਤੋਂ ਬਾਅਦ ਦੈਟਸ ਫਾਈਨ